ਮੈਨੂੰ ਲੱਗਦਾ ਪਿੰਡਾਂ ਦੇ ਬੱਚਿਆਂ ਨੂੰ ਤਾਂ ਹਰ ਫੀਲਡ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਗੱਲ ਡਾਂਸਰਾਂ ਦੀ ਹੈ ਡਾਂਸਰ ਬੱਚਿਆਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਇਹਦਾ ਸਭ ਤੋਂ ਮੇਨ ਕਾਰਨ ਤਾਂ ਸਾਧਨਾਂ ਦੀ ਘਾਟ ਹੈ ਕਿਉਂਕਿ ਪਿੰਡਾਂ ਦੇ ਵਿੱਚ ਆਣ ਜਾਣ ਲਈ ਬੰਨਵੀਆਂ ਬੱਸਾਂ ਹੁੰਦੀਆਂ ਨੇ ਔਰ ਜਿਹੜੇ ਵੀ ਕੋਚਿੰਗ ਸੈਂਟਰ ਡਾਂਸਰ ਬੱਚਿਆਂ ਲਈ ਡਾਂਸ ਦੇ ਕੋਚਿੰਗ ਸੈਂਟਰ ਹੁੰਦੇ ਨੇ ਉਹ ਸ਼ਹਿਰਾਂ ਦੇ ਵਿੱਚ ਹੀ ਬਣੇ ਹੁੰਦੇ ਨੇ ਬੱਸਾਂ ਦਾ ਟਾਈਮ ਫਿਕਸ ਹੋਣ ਕਰਕੇ ਬੱਚਿਆਂ ਨੂੰ ਆਣ ਜਾਣ 'ਚ ਬਹੁਤ ਦਿੱਕਤ ਆਉਂਦੀ ਹੈ ਅਤੇ ਉਹਨਾਂ ਨੂੰ ਉਸਦਾ ਖਰਚਾ ਵੀ ਬਹੁਤ ਮਹਿੰਗਾ ਪੈਂਦਾ ਹੈ ਉਸ ਤੋਂ ਬਾਅਦ ਜਿਹੜੇ ਕੋਚਿੰਗ ਸੈਂਟਰ ਸ਼ਹਿਰਾਂ ਦੇ ਵਿੱਚ ਨੇ ਉਹ ਬਹੁਤ ਮਹਿੰਗੇ ਹੁੰਦੇ ਨੇ ਪਿੰਡਾਂ 'ਚ ਆ ਕੇ ਕੋਈ ਡਾਂਸ ਸਿਖਾਉਂਦਾ ਨਹੀਂ ਇਸ ਕਰਕੇ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਵਿੱਚ ਆ ਕੇ ਹੀ ਡਾਂਸ ਸਿੱਖਣਾ ਪੈਂਦਾ ਕਲਾਸ ਦੋ ਘੰਟੇ ਦੀ ਹੁੰਦੀ ਹੈ ਤਿੰਨ ਘੰਟੇ ਦੀ ਹੁੰਦੀ ਹੈ ਉਹ ਬੱਚਿਆਂ ਨੂੰ ਉੱਥੇ ਬੱਸ ਸਟੈਂਡ 'ਤੇ ਬੈਠ ਕੇ ਹੀ ਬੱਸ ਦੀ ਵੇਟ ਕਰਨੀ ਪੈਂਦੀ ਹੈਗੀ ਕਿਉਂਕਿ ਬੱਸਾਂ ਬੰਨਵੀਆਂ ਹੋਣ ਕਰਕੇ ਬੱਸ ਤਾਂ ਆਪਣੇ ਟਾਈਮ 'ਤੇ ਆਊਗੀ ਔਰ ਕੋਚਿੰਗ ਸੈਂਟਰਾਂ ਦੇ ਵਿੱਚ ਇੱਕ ਗਰੁੱਪ ਤੋਂ ਬਾਅਦ ਦੂਸਰਾ ਗਰੁੱਪ ਦੂਸਰੇ ਗਰੁੱਪ ਤੋਂ ਬਾਅਦ ਤੀਸਰਾ ਗਰੁੱਪ ਉੱਥੋਂ ਬੱਚਿਆਂ ਨੂੰ ਆਉਣਾ ਪੈਂਦਾ ਹੈ ਇਹ ਵੀ ਬਹੁਤ ਵੱਡੀ ਚੁਣੌਤੀ ਹੈ ਬੱਚਿਆਂ ਲਈ ਗਰਮੀ 'ਚ ਵੀ ਬੱਚਿਆਂ ਨੂੰ ਔਖਾ ਹੈ ਸਰਦੀਆਂ 'ਚ ਵੀ ਬੱਚਿਆਂ ਨੂੰ ਔਖਾ ਹੈ ਸਰਦੀਆਂ 'ਚ ਜਿਵੇਂ ਕਿ ਕੁੜੀਆਂ ਡਾਂਸ ਸਿੱਖਦੀਆਂ ਨੇ ਉਹਨਾਂ ਨੂੰ ਗਰਮੀਆਂ 'ਚ ਵੀ ਔਖਾ ਸਰਦੀਆਂ 'ਚ ਵੀ ਔਖਾ ਵਿਚਾਰੀਆਂ ਨੂੰ ਘਰੇ ਆਉਂਦੀਆਂ ਨੂੰ ਹਨੇਰਾ ਹੋ ਜਾਂਦਾ ਇਸ ਦਾ ਫਿਰ ਪ੍ਰਭਾਵ ਵੀ ਬੁਰਾ ਪੈਂਦਾ ਘਰਦੇ ਵੀ ਨਾਰਾਜ਼ ਹੁੰਦੇ ਨੇਗੇ ਪਰ ਬੱਚੇ ਦਾ ਡਾਂਸ ਸ਼ੌਂਕ ਹੈ ਤਾਂ ਘਰ ਦੇ ਮਨ੍ਹਾ ਵੀ ਨਹੀਂ ਕਰ ਸਕਦੇ ਬੱਚਿਆਂ ਨੂੰ ਲਗਾਉਂਦੇ ਨੇ ਕੋਚਿੰਗ ਸੈਂਟਰਾਂ 'ਚ ਕੋਚਿੰਗ ਸੈਂਟਰ ਦੂਰ ਹੋਣ ਕਰਕੇ ਬੱਚਿਆਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ